ਸਤਿ ਸ਼੍ਰੀ ਅਕਾਲ ਮੈਂ ਦੀਆ ਰਾਣੀ ਤੁਸੀਂ ਮਾਰੂਤੀ ਏਜੰਸੀ ਤੋਂ ਬੋਲ ਰਹੇ ਹੋ ਹਾਂਜੀ ਮੈਂ ਤੁਹਾਡੀ ਏਜੰਸੀ 'ਚੋਂ ਮਾਰੂਤੀ ਮਾਡਲ ਦੋ ਹਜ਼ਾਰ ਬਾਈ ਲੈ ਕੇ ਗਈ ਸੀ ਜੋ ਹੁਣ ਜਦੋਂ ਅਸੀਂ ਹਿਮਾਚਲ ਪਹੁੰਚੇ ਤਾਂ ਉੱਥੇ ਉਹ ਖਰਾਬ ਹੋ ਗਈ ਹੈ ਉਹਦਾ ਪੈਂਚਰ ਹੋ ਗਿਆ ਹੈ ਹੁਣ ਇਸ ਅ ਆਲੇ ਦੁਆਲੇ ਕੋਈ ਹੋਰ ਹੋਰ ਟਾਇਰ ਪੈਂਚਰ ਵਾਲੀ ਕੋਈ ਦੁਕਾਨ ਵੀ ਨਹੀਂ ਹੈ ਇਸ ਲਈ ਮੈਨੂੰ ਇਸ ਦੇ ਬਾਰੇ ਸਲਾਹ ਦਿੱਤੀ ਜਾਵੇ ਤਾਂ ਜੋ ਇਸ ਨੂੰ ਜਲਦੀ ਤੋਂ ਜਲਦੀ ਠੀਕ ਕਰਵਾਇਆ ਜਾਵੇ ਮੇਰਾ ਪਰਿਵਾਰ ਮੇਰੇ ਨਾਲ ਹੈ ਇਸ ਲਈ ਇਸ ਸੰਬੰਧੀ ਮੈਨੂੰ ਜਾਣਕਾਰੀ ਦਿੱਤੀ ਜਾਵੇ ਕਿ ਜਲਦੀ ਤੋਂ ਜਲਦੀ ਕਾਰ ਦਾ ਪੈਂਚਰ ਠੀਕ ਹੋ ਸਕੇ